ਜਦੋਂ ਮੈਂ ਆਪਣੀ ਰਸੋਈ ਦੀ ਗੱਲ ਕਰਦਾ ਹਾਂ ਅਤੇ ਉਹਨਾਂ ਦੀ ਤਿਆਰੀ ਦੀ ਗੱਲ ਕਰਦਾ ਹਾਂ ਤਾਂ ਮੈਂ ਆਪਣੇ ਪੁਰਾਣੇ ਦਿਨਾਂ ਦੇ ਅਨੁਭਵ ਅਤੇ ਵੱਖਰੇ ਉਪਕਰਨ ਬਾਰੇ ਸੋਚਦਾ ਹਾਂ ਜਦੋਂ ਕਿ ਅਜਿਹਾ ਮਾਡਰਨ ਉਪਕਰਨ ਉਪਲਬਧ ਨਹੀਂ ਸਨ ਜਿਵੇਂ ਕਿ ਮਿਕਸਰ ਗਰਾਇੰਡਰ ਗੈਸ ਸਿਲੰਡਰ ਓਵਨ ਅਤੇ ਹੋਰ ਹੋਰ ਪੁਰਾਣੇ ਦਿਨਾਂ 'ਚ ਰਸੋਈ ਵਿੱਚ ਹਮੇਸ਼ਾ ਇੱਕ ਸਿੰਪਲ ਗੈਸ ਚੁੱਲ੍ਹਾ ਹੁੰਦਾ ਸੀ ਜਿਸ ਨੂੰ ਤੰਦੂਰ ਵੀ ਕਹਿੰਦੇ ਸਨ ਉਹ ਚੁੱਲ੍ਹਾ ਸਿਰਫ ਗਲਾਸ ਦੀ ਨਾਲ ਨਹੀਂ ਬਲਕਿ ਲੱਕੜੀ ਦੀ ਅੱਗ ਦੀ ਮਦਦ ਨਾਲ ਜਲਦਾ ਸੀ ਉਹ ਇੱਕ ਸਧਾਰਨ ਪਰ ਧਨ ਦੀ ਹੁੰਦਾ ਸੀ ਜਿਸ ਨੂੰ ਨਾਲ ਕਿ ਸਬਜ਼ੀਆਂ ਰੋਟੀਆਂ ਅਤੇ ਵਧੀਆ ਪਰਾਂਠੇ ਬਣਾਏ ਜਾਂਦੇ ਸਨ ਉਹਨਾਂ ਦੇ ਨਾਲ ਹਮੇਸ਼ਾ ਇੱਕ ਵੱਡੀ ਹਾਂਡੀ ਅਤੇ ਇੱਕ ਕੜਾਹੀ ਹੁੰਦੀ ਸੀ ਜਿਨ੍ਹਾਂ ਵਿੱਚ ਮੈਂ ਆਮਲੇ ਬਣਾਉਂਦਾ ਸੀ ਕੜੀ ਦੀ ਤਿਆਰੀ ਕਰਦੇ ਸੀ ਅਤੇ ਪਰਾਂਠੇ ਵੀ ਬਣਾਉਂਦੇ ਸੀ ਮੈਂ ਉਹਨਾਂ ਦਿਨਾਂ ਨੂੰ ਯਾਦ ਕਰਦਾ ਹਾਂ ਵੱਖਰੇ ਉਪਕਰਨ ਦਾ ਇੱਕ ਉਦਾਹਰਨ ਓਵਨ ਸੀ ਜਿਹਦਾ ਜਿਹਾ ਉਪਲਬਧ ਨਹੀਂ ਸੀ ਮੇਰੇ ਦਿਨਾਂ 'ਚ ਅਸੀਂ ਤਵਿਆਂ ਰੋਟੀਆਂ ਬਣਾਉਂਦੇ ਸੀ ਜਿਹੜੀਆਂ ਹਮੇਸ਼ਾ ਚੁੱਲ੍ਹੇ 'ਤੇ ਸੇਕਆਂ ਜਾਂਦੀਆਂ ਸਨ ਅਤੇ ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਰੋਟੀਆਂ ਸੇਕਦੀਆਂ ਸਨ ਅਤੇ ਉਹਨਾਂ ਦੀ ਖੁਸ਼ਬੂ ਪੂਰੀ ਗਲੀ ਵਿੱਚ ਫੈਲੀ ਜਾਂਦੀ ਸੀ ਓਵਨ ਦੀ ਕਮੀ ਵਿੱਚ ਅਸੀਂ ਰੋਟੀਆਂ ਲੱਕੜੀ ਦੀ ਤਵੀ 'ਤੇ ਸੇਕਦੇ ਸਨ ਜਿਹੜੀਆਂ ਆਪਣੇ ਆਪਣੇ ਸਵਾਦ 'ਚ ਵਧੀਆ ਬਣਾਈਆਂ ਕਰਦੀਆਂ ਸਨ ਬਣਦੀਆਂ ਕਰਦੀਆਂ ਸਨ ਮੈਂ ਸਮਝਦਾ ਹਾਂ ਕਿ ਅਜਿਹਾ ਵੱਖਰਾ ਉਪਕਰਨ ਨਾਲ ਰਸੋਈ ਦੀ ਤਿਆਰੀ ਦੀ ਅਨੁਭਵ ਆਪਣੇ ਪੁਰਾਣੇ ਦਿਨਾਂ ਵਾਲੇ ਨਾਲ ਬਿਲਕੁਲ ਵੀ ਮੁਕਾਬਲਾ ਨਹੀਂ ਕਰ ਸਕਦਾ ਪਰ ਉਹਨਾਂ ਦਿਨਾਂ ਦੇ ਸਾਧਾਰਨ ਉਪਕਰਨ ਨੇ ਸਨ ਜੋ ਸਾਨੂੰ ਸਿੰਪਲ ਲਿਵਿੰਗ ਦੀ ਇਹ ਕਦਰ ਸਿਖਾਉਦੀਆਂ ਸਨ ਉਹਨਾਂ ਦਿਨਾਂ ਹਰ ਕੁਝ ਇੰਨਾ ਫਾਸਟ ਪੇਸਡ ਨਹੀਂ ਸੀ